ਹੈਲੋ ਗੁੱਡ ਆਫਟਰਨੂਨ ਮੈਮ ਯੇਸ ਮੇਅ ਆਈ ਹੈਲਪ ਯੂ ਹਾਂਜੀ ਮੈਮ

ਹਾਂਜੀ ਹਾਂਜੀ ਠੀਕ ਹੈ ਕੋਈ ਤੁਸੀਂ ਮੈਡੀਸਨ ਲਈ ਪਹਿਲਾਂ ਹਾਂਜੀ ਕੀ ਨਾਮ ਦੱਸਿਓ ਆਪਣਾ ਨਾਮ ਕੀ ਹੈ ਤੁਹਾਡਾ ਠੀਕ ਹੈ ਮੈਡਮ ਓਕੇ ਤੁਸੀਂ ਕਿਵੇਂ ਕੋਲਡ ਕਿਵੇਂ ਹੋਇਆ ਤੁਹਾਨੂੰ ਅੱਛਾ ਜੀ ਠੀਕ ਹੈ ਅੱਛਾ ਇੱਕ ਤਾਂ ਦੇਖੋ ਮੈਡਮ ਕ ਕਿੱਦਾਂ ਕੋਲਡ ਤੁਹਾਨੂੰ ਅੱਖਾਂ ਵਿੱਚੋਂ ਪਾਣੀ ਆ ਰਿਹਾ ਸਿਰ ਦਰਦ ਹੋ ਰਿਹਾ ਅੱਛਾ ਗਲਾ ਵੀ ਦਰਦ ਹੋ ਰਿਹਾ ਠੀਕ ਹੈ ਮੈਡਮ ਦੇਖੋ ਇਹ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਹੈ ਇੱਕ ਤਾਂ ਵਾਇਰਲ ਥੋੜ੍ਹਾ ਤੁਹਾਨੂੰ ਪਤਾ ਮੌਸਮ ਦੇ ਨਾਲ ਮੌਸਮ ਚੇਂਜ ਹੋ ਰਿਹਾ ਨਾ ਉਹਦੇ ਕਰਕੇ ਸੁੱਕੀ ਠੰਢ ਪੈ ਰਹੀ ਹੈ ਤੁਹਾਨੂੰ ਪਤਾ ਹੈ ਨਾ ਅਤੇ ਉਹਦੇ ਕਰਕੇ ਥੋੜ੍ਹਾ ਜਿਹਾ ਇੱਕ ਤਾਂ ਪਾਣੀ ਗਰਮ ਪੀਓ ਆਪਣੇ ਆਪ ਨੂੰ ਥੋੜ੍ਹਾ ਗਰਮ ਰੱਖੋ ਸਿਰ ਨੂੰ ਕਵਰ ਕਰਕੇ ਰੱਖੋ ਠੀਕ ਹੈ ਗਰਮ ਰੱਖੋ ਆਪਣੇ ਆਪ ਨੂੰ ਅਤੇ ਆਪਣਾ ਕਾੜ੍ਹਾ ਵਗੈਰਾ ਘਰ ਬਣਾ ਕੇ ਪੀਓ ਅਤੇ ਮੈਡੀਸਨ ਤੁਹਾਡੇ ਕੋਲ ਕੋਈ ਨਹੀਂ ਹੈਗੀ ਹੁਣ ਅੱਛਾ ਕੋਈ ਨਹੀਂ ਮੈਡਮ ਇਹਦੇ ਵਿੱਚ ਇੱਦਾਂ ਹੁੰਦਾ ਕਿ ਵਾਇਰਲ ਜਿਹੜਾ ਹੁੰਦਾ ਨਾ ਮੌਸਮ ਦੇ ਹਿਸਾਬ ਨਾਲ ਜਿਹੜਾ ਮੌਸਮ ਦੇ ਹਿਸਾਬ ਨਾਲ ਸਾਨੂੰ ਜੁਕਾਮ ਸਰਦੀ ਹੁੰਦੀ ਹੈ ਨਾ ਉਹ ਜ਼ਿਆਦਾ ਮੈਡੀਸਨ ਦੇ ਨਾਲ ਠੀਕ ਨਹੀਂ ਹੁੰਦੀ ਤੁਸੀਂ ਘਰ ਦਾ ਹੀ ਆਪਣਾ ਕਾੜ੍ਹਾ ਕੋਈ ਭਾਫ ਲਓ ਠੀਕ ਹੈ ਭਾਫ ਲਓ ਥੋੜ੍ਹਾ ਜਿਹਾ ਅਤੇ ਗਰਮ ਚੀਜ਼ਾਂ ਖਾਓ ਥੋੜ੍ਹੀ ਜਿਹੀਆਂ ਗਰਮ ਖਾਓ ਆਪਣੇ ਸਿਰ ਨੂੰ ਕਵਰ ਕਰਕੇ ਰੱਖੋ ਆਪਣੇ ਸਵੈਟਰ ਵਗੈਰਾ ਪਾ ਕੇ ਰੱਖੋ ਠੀਕ ਹੈ ਅਤੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਤੁਸੀਂ ਕਾਹੜਾ ਵਗੈਰਾ ਬਣਾ ਕੇ ਪੀਓ ਗਰਮ ਪਾਣੀ ਦਾ ਅਤੇ ਕੋਲਡ ਦੀ ਜਿਹੜੀ ਦਵਾਈ ਹੈ ਤੁਸੀਂ ਇੱਕ ਵਾਰੀ ਲੈ ਲਓ ਜ਼ਿਆਦਾ ਨਹੀਂ ਲੈਣ ਦੀ ਲੋੜ ਹੈਗੀ ਠੀਕ ਹੈ ਅਤੇ ਠੰਢਾ ਨਹੀਂ ਖਾਣਾ ਹੈਗਾ ਠੰਢਾ ਨਾ ਖਾਇਓ ਗਰਮ ਚੀਜ਼ਾਂ ਹੀ ਜ਼ਿਆਦਾ ਖਾਓ ਠੀਕ ਹੈ ਠੀਕ ਹੈ ਅਤੇ ਧੁੱਪ ਵਿੱਚ ਲੀਟੋ ਥੋੜ੍ਹਾ ਰੈਸਟ ਕਰੋ ਹਵਾ ਹਵਾ ਤੋਂ ਬਚਾ ਕੇ ਰੱਖੋ ਆਪਣੇ ਆਪ ਨੂੰ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਕੋਈ ਗੱਲ ਨਹੀਂ ਜੀ ਰਿਲੈਕਸ ਹਾਂਜੀ ਹਾਂਜੀ ਹਾਂਜੀ ਮੈਨੂੰ ਪਤਾ ਤੁਹਾਨੂੰ ਜ਼ਿਆਦਾ ਦਵਾਈ ਨਾਲ ਫਰਕ ਨਹੀਂ ਪੈਂਦਾ ਹੈਗਾ ਤੁਸੀਂ ਆਪਣੇ ਘਰ ਦੇ ਸਗੋਂ ਘਰੇਲੂ ਇਲਾਜ ਕਰੋ ਉਹਦੇ ਨਾਲ ਜ਼ਿਆਦਾ ਫਰਕ ਪੈਂਦਾ ਤੁਲਸੀ ਪਾ ਲਓ ਪਾਣੀ ਵਿੱਚ ਤੁਲਸੀ ਪਾਓ ਵੱਡੀ ਇਲਾਚੀ ਪਾਓ ਹੈ ਨਾ ਇਹ ਪਾ ਕੇ ਥੋੜ੍ਹਾ ਕਾੜ੍ਹਾ ਬਣਾ ਕੇ ਨਾ ਸੌਂ ਜਾਓ ਥੋੜ੍ਹੀ ਦੇਰ ਗਰਮ ਹੋ ਕੇ ਸੌਂ ਜਾਓ ਅਤੇ ਉਹਦੇ ਨਾਲ ਠੀਕ ਮਹਿਸੂਸ ਕਰੋਗੇ ਠੀਕ ਹੈ ਜੀ ਠੀਕ ਹੈ ਓਕੇ ਓਕੇ ਜੀ